ਗਾਇਕੀ ਵਿੱਚ ਅਸੀਂ ਗਾ ਕੇ ਆਪਣੀਆਂ ਮਨ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਹਾਂ ਜੋ ਅਸੀਂ ਗੱਲ ਕਿਸੀ ਨੂੰ ਅਸ ਕਹਿ ਨਹੀਂ ਸਕਦੇ ਉਹ ਅਸੀਂ ਗਾ ਕੇ ਦਰਸਾਉਣਾ ਚਾਹੁੰਦੇ ਹਾਂ ਇਸ ਤਰ੍ਹਾਂ ਅਸੀਂ ਸੰਗੀਤ ਦੇ ਰਾਹੀਂ ਇਸ ਗਾਇਕੀ ਦੇ ਰਾਹੀਂ ਆਪਣੀ ਭਾਵਨਾਵਾਂ ਦੱਸਣਾ ਚਾਹੁੰਦੇ ਹਾਂ ਇਹ ਗਾਇਕੀ ਅਸੀਂ ਸ਼ੇਰੋ ਸ਼ਾਇਰੀ ਦੇ ਰਾਹੀਂ ਕਵਿਤਾਵਾਂ ਦੇ ਰਾਹੀਂ ਜਾਂ ਗੀਤ ਦੇ ਰਾਹੀਂ ਪ੍ਰਗਟ ਕਰ ਸਕਦੇ ਹਾਂ